ਮੈਂ ਫਤਿਹਗੜ੍ਹ ਸਾਹਿਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਿਜ ਦੇ ਫਲੈਟਾਂ ਵਿੱਚ ਰਹਿੰਦੀ ਹਾਂ ਅਤੇ ਮੇਰੇ ਆਲ਼ੇ ਦੁਆਲ਼ੇ ਬਹੁਤ ਸਾਰੀਆਂ ਲਾਈਬ੍ਰੇਰੀਆਂ ਹਨ ਪਹਿਲਾਂ ਤਾਂ ਸਾਡੇ ਕਾਲਜ ਦੀ ਲਾਈਬ੍ਰੇਰੀ ਅਤੇ ਹੋਰ ਕਾਲਜ ਦੇ ਆਲ਼ੇ ਦੁਆਲ਼ੇ ਨਾਲ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਕਾਲਜਾਂ ਦੀਆਂ ਲਾਈਬ੍ਰੇਰੀਆਂ ਫਿਰ ਗੁਰਦੁਆਰਾ ਸਾਹਿਬ ਦੀ ਲਾਈਬ੍ਰੇਰੀ ਅਤੇ ਡਿਸਟ੍ਰਿਕ ਵੱਲੋਂ ਸਰਕਾਰ ਵੱਲੋਂ ਲਗਾਈ ਗਈ ਡਿਸਟ੍ਰਿਕ ਲਾਈਬ੍ਰੇਰੀ

ਮੈਂ ਅੰਮ੍ਰਿਤਾ ਪ੍ਰੀਤਮ ਪ੍ਰੋਫੈਸਰ ਪੂਰਨ ਸਿੰਘ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਬਹੁਤ ਵਾਰ ਇਸ਼ੂ ਕਰਵਾਈਆਂ ਹਨ ਅਤੇ ਮੈਨੂੰ ਹਰ ਵਾਰੀ ਹੀ ਪੜ੍ਹ ਕੇ ਉਨਾ ਹੀ ਮਜ਼ਾ ਆਉਂਦਾ ਹੈ ਮੈਨੂੰ ਲਾਈਬ੍ਰੇਰੀ ਦੇ ਵਿੱਚ ਖਿੜਕੀ ਨੇੜੇ ਬਹਿ ਕੇ ਪੜ੍ਹਨ ਨਾਲ ਬੜਾ ਚੰਗਾ ਲੱਗਦਾ ਹੈ ਨਿੰਮੀ ਨਿੰਮੀ ਧੁੱਪ ਪੈ ਰਹੀ ਹੁੰਦੀ ਹੈ ਅਤੇ ਸਾਡੇ ਕਾਲਜ ਦੀ ਲਾਈਬ੍ਰੇਰੀ ਦੇ ਵੱਡੇ ਸ਼ੀਸ਼ਿਆਂ ਰਾਹੀਂ ਸਰਦੀਆਂ ਵਿੱਚ ਉਹ ਅੰਦਰ ਆ ਕੇ ਬੜਾ ਨਿੱਘ ਕਰਦੀ ਹੈ ਅਤੇ ਲਾਈਬ੍ਰੇਰੀ ਅੰਦਰ ਹੋਰ ਵੀ ਵਿਦਿਆਰਥੀ ਬੜੇ ਆਉਂਦੇ ਹਨ ਜਿਨਾਂ ਕਰਕੇ ਪੜ੍ਹਨ ਵਾਲਾ ਮਾਹੌਲ ਬਣਿਆ ਹੁੰਦਾ ਹੈ ਅਤੇ ਪੜ੍ਹਨਾ ਸੌਖਾ ਹੋ ਜਾਂਦਾ ਹੈ ਤਾਂ ਮੈਂ ਅਕਸਰ ਲਾਈਬ੍ਰੇਰੀ ਜਾਂਦੀ ਆਉਂਦੀ ਰਹਿੰਦੀ ਹਾਂ